ਪੰਜਾਬ ਵਿੱਚ ਬੜੇ ਤਰ੍ਹਾਂ ਦੇ ਮੇਲੇ ਬਣ ਮਤਲਬ ਲੱਗਦੇ ਆ ਕਿਉਂਕਿ ਪੰਜਾਬ ਤਾਂ ਵੈਸੇ ਵੀ ਮੇਲਿਆਂ ਅਤੇ ਗੁਰੂਆਂ ਦੀ ਧਰਤੀ ਕਿਹਾ ਜਾਂਦਾ ਅਤੇ ਪੰਜਾਬ ਦੇ ਲੋਕ ਵੀ ਮੇਲਿਆਂ ਦੇ ਬੜੇ ਸ਼ੌਕੀਨ ਹਨ ਖਾਸ ਕਰਕੇ ਵਿਸਾਖੀ ਦਾ ਮੇਲਾ ਮਾਘੀ ਦਾ ਮੇਲਾ ਵਿਸਾਖੀ ਦਾ ਮੇਲਾ ਫਸਲ ਕੱਟਣ ਤੋਂ ਬਾਅਦ ਫਸਲ ਕੱਟਣ ਦੀ ਖੁਸ਼ੀ 'ਚ ਮਨਾਇਆ ਜਾਂਦਾ ਅਪ੍ਰੈਲ ਦੇ ਮਹੀਨੇ 'ਚ ਅਤੇ ਮਾਘੀ ਦਾ ਮੇਲਾ ਵੀ ਬੜੇ ਉਤਸਾਹ ਨਾਲ ਮੁਕਤਸਰ ਸਾਹਿਬ 'ਚ ਮ ਮਤਲਬ ਬੜਾ ਭਾਰੀ ਮੇਲਾ ਲੱਗਦਾ ਅਤੇ ਇਹ ਮੇਲੇ ਅਤੇ ਤਿਉਹਾਰ ਪੰਜਾਬ ਦੀ ਕਲਾ ਨੂੰ ਪ੍ਰਦਰਸ਼ਿਤ ਕਰਨ ਦਾ ਬੜਾ ਅੱਛਾ ਮਾਧਿਅਮ ਹਨ ਇਹ ਪੰਜਾਬ ਦੀ ਕਲਾ ਨੂੰ ਸਾਰਿਆਂ ਸਾਹਮਣੇ ਬੜੀ ਅੱਛੀ ਤਰ੍ਹਾਂ ਦਿਖਾਇਆ ਜਾਂਦਾ ਅਤੇ ਇਹਨਾਂ ਤਿਉਹਾਰਾਂ 'ਚ ਇੰਨਾਂ ਮੇਲਿਆਂ 'ਚ ਸਾਰੇ ਮਤਲਬ ਪੰਜਾਬ ਦੇ ਲੋਕ ਬੜੇ ਉਤਸ਼ਾਹ ਨਾਲ ਜਾਂਦੇ ਆ ਉੱਥੇ ਫੁਲਕਾਰੀਆਂ ਦੀ ਪ੍ਰਦਰਸ਼ਨੀ ਲੱਗੀ ਹੁੰਦੀ ਹੈ ਜਿੱਥੇ ਕਿ ਆਪਾਂ ਨੂੰ ਪਤਾ ਲੱਗਦਾ ਕਿ ਕਿੰਨੀ ਤਰ੍ਹਾਂ ਦੀ ਫੁਲਕਾਰੀਆਂ ਪੰਜਾਬ 'ਚ ਪ੍ਰਚਲਿਤ ਹਨ ਅਤੇ ਉੱਥੇ ਹੋਰ ਵੀ ਬਥੇਰੇ ਤਰ੍ਹਾਂ ਦੀ ਪ੍ਰਦਰਸ਼ਨੀਆਂ ਲਗਾਈ ਜਾਂਦੀਆਂ ਹਨ ਜਿਹਦੇ 'ਚ ਆਪਣੇ ਪੰਜਾਬ ਦੀ ਕਲਾ ਪੰਜਾਬ ਦਾ ਵਿਰਸਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਵੇਂ ਕਿ ਪੰਜਾਬ ਹੈਰੀਟੇਜ ਮੇਲਾ ਲੱਗਦਾ ਚੰਡੀਗੜ੍ਹ 'ਚ ਅਤੇ ਹੋਰ ਵੀ ਕਈ ਤਰ੍ਹਾਂ ਦੇ ਹਰੇਕ ਜ਼ਿਲ੍ਹੇ 'ਚ ਹਰੇਕ ਥਾਂ 'ਤੇ ਕੋਈ ਨਾ ਕੋਈ ਕਿਸੇ ਨਾ ਕਿਸੇ ਦੀ ਯਾਦ 'ਚ ਮੇਲੇ ਲੱਗਦੇ ਰਹਿੰਦੇ ਆ ਅਤੇ ਆਹੀ ਮੇਲਿਆਂ ਦੇ ਥਰੂ ਹੀ ਜਿਹੜਾ ਆਪਾਂ ਵਿਰਸਾ ਆਪਣਾ ਉਹ ਸੰਭਾਲ ਸਕਦੇ ਹਾ ਅਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਉਸ ਵਿਰਸੇ ਬਾਰੇ ਆਪਾਂ ਦੱਸ ਸਕਦੇ ਹਾਂ ਇਸ ਕਰਕੇ ਇਹ ਮੇਲੇ ਔਰਗੇਨਾਈਜ ਕਰਨੇ ਬਹੁਤ ਜ਼ਰੂਰੀ ਹਨ ਧੰਨਵਾਦ